ਪੰਜਾਬੀ ਭਾਸ਼ਾ ਦੀ ਤੁਲਨਾ ਹੋਰ ਭਾਸ਼ਾਵਾਂ ਜਿਵੇਂ ਕਿ ਹਿੰਦੀ ਉਰਦੂ ਅਤੇ ਫਾਰਸੀ ਦੇ ਨਾਲ ਥੋੜ੍ਹੀ ਬਹੁਤ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਪੰਜਾਬੀ ਹਿੰਦੀ ਅਤੇ ਉਰਦੂ ਦੇ ਕਾਫੀ ਸਾਰੇ ਸ਼ਬਦ ਇੱਕ ਦੂਜੇ ਦੇ ਨਾਲ ਮਿਲਦੇ ਜੁਲਦੇ ਹਨ ਜਿਨ੍ਹਾਂ ਦਾ ਮਤਲਬ ਵੀ ਤਿੰਨੋਂ ਚਾਰੋਂ ਭਾਸ਼ਾਵਾਂ ਦੇ ਲਈ ਸੇਮ ਬਣਦਾ ਹੈ ਸੋ ਇਸ ਲਈ ਇਹਨਾਂ ਤਿੰਨੋਂ ਚਾਰੋਂ ਭਾਸ਼ਾਵਾਂ ਦੀ ਤੁਲਨਾ ਇੱਕ ਦੂਜੇ ਦੇ ਨਾਲ ਕੀਤੀ ਜਾਂਦੀ ਹੈ ਪਰ ਮੈਂ ਸੋਚਦਾ ਹਾਂ ਕਿ ਪੰਜਾਬੀ ਇੱਕ ਆਪਣੀ ਅਲੱਗ ਤੋਂ ਭਾਸ਼ਾ ਅਤੇ ਲਿਪੀ ਹੈ ਜਿਸ ਦੇ ਹਰ ਸ਼ਬਦ ਦਾ ਅਲੱਗ ਮਤਲਬ ਪੰਜਾਬੀ ਦੇ ਵਿੱਚ ਹੀ ਬਣਦਾ ਹੈ ਇਸ ਲਈ ਪੰਜਾਬੀ ਭਾਸ਼ਾ ਦੇ ਨਾਲ ਹੋਰ ਭਾਸ਼ਾਵਾਂ ਦੀ ਤੁਲਨਾ ਨਾ ਕੀਤੀ ਜਾਵੇ ਤਾਂ ਇਹ ਬਿਹਤਰ ਹੋਵੇਗਾ